ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਿੰਕੀ ਹੈ ਮੈਂ ਗੁਰਦਾਸਪੁਰ ਦੇ ਵਿੱਚ ਰਹਿਣ ਵਾਲੀ ਹਾਂ ਅਤੇ ਮੈਨੂੰ ਪੰਜਾਬੀ ਪੰਜਾਬੀ ਸਾਡੀ ਮਾਂ ਬੋਲੀ ਆ ਅਸੀਂ ਪੰਜਾਬੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ ਅਸੀਂ ਹਰ ਇੱਕ ਕੰਮ ਪੰਜਾਬੀ ਵਿੱਚ ਹੀ ਕਰਦੇ ਹਾਂ ਜਿਵੇਂ ਕਿ ਅਸੀਂ ਸਕੂਲ ਜਾਈਏ ਜਾਂ ਕਿਸੇ ਸਕੂਲ ਵਿੱਚ ਜਾਈਏ ਉੱਥੇ ਵੀ ਅਸੀਂ ਪੰਜਾਬੀ ਵਿੱਚ ਹੀ ਕੰਮ ਵਗੈਰਾ ਕਰਦੇ ਹਨ ਅਸੀਂ ਪੰਜਾਬੀ ਸ਼ੁਰੂ ਤੋਂ ਹੀ ਅਸੀਂ ਸਕੂਲ ਵਿੱਚ ਪੰਜਾਬੀ ਹੀ ਪੜ੍ਹੀ ਹੈ ਪੰਜਾਬੀ ਹੀ ਪੜ੍ਹੀ ਹੈ ਅਤੇ ਅਸੀਂ ਕਿਸੇ ਦੇ ਕਿਸੇ ਦੇ ਨਾਲ ਗੱਲ ਵਗੈਰਾ ਕਰਦੇ ਹਾਂ ਤਾਂ ਅਸੀਂ ਉਸ ਵੇਲੇ ਵੀ ਪੰਜਾਬੀ ਵਿੱਚ ਹੀ ਗੱਲ ਕਰਦੇ ਹਾਂ ਅਤੇ ਅਸੀਂ ਕਿਤੇ ਫੋਰਮ ਫੋਮ ਭਰੀਏ ਕਿਤੇ ਦਫ਼ਤਰ ਜਾਈਏ ਸਕੂਲੇ ਸਕੂਲ ਜਾਈਏ ਦਫ਼ਤਰ ਜਾਈਏ ਕਿਤੇ ਵੀ ਜਾਈਏ ਅਸੀਂ ਪੰਜਾਬੀ ਵਿੱਚ ਹੀ ਫੋਮ ਫੀਲ ਕਰਦੇ ਹਨ ਅਤੇ ਪੰਜਾਬੀ ਪੰਜਾਬੀ ਸਾਨੂੰ ਬਹੁਤ ਹੀ ਪਸੰਦ ਹੈ ਪੰਜਾਬੀ ਪੰਜਾਬੀ ਵਿੱਚ ਹੀ ਅਸੀਂ ਭੰਗੜਾ ਵਗੈਰਾ ਪਾਉਂਦੇ ਹਾਂ ਅਤੇ ਪੰਜਾਬੀ ਗਾਣੇ ਵਗੈਰਾ ਸਾਰਾ ਕੁਛ ਅਸੀਂ ਪੰਜਾਬੀ ਵਿੱਚ ਹੀ ਪਸੰਦ ਕਰਦੇ ਹਨ ਜਿਸ ਤਰ੍ਹਾਂ ਹੀ ਜਿਸ ਤਰ੍ਹਾਂ ਹੀ ਕੋਈ ਫੰਕਸ਼ਨ ਵਗੈਰਾ ਹੁੰਦਾ ਹੈ ਅਸੀਂ ਸਾਰੀਆਂ ਲੜਕੀਆਂ ਰਲ ਕੇ ਪੰਜਾਬੀ ਗਾਣੇ ਲਾ ਕੇ ਪੰਜਾਬੀ ਗਾਣੇ 'ਤੇ ਬਹੁਤ ਜ਼ਿਆਦਾ ਭੰਗੜਾ ਵਗੈਰਾ ਪਾਉਂਦੇ ਹਨ ਅਤੇ ਜਦੋਂ ਅਸੀਂ ਕਿਸੇ ਦੇ ਘਰ ਜਾਈਏ ਉੱਥੇ ਜਾ ਕੇ ਅਸੀਂ ਪਹਿਲਾਂ ਕਿਸੇ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਚਾਹ ਪਾਣੀ ਵਗੈਰਾ ਪੀ ਕੇ ਫਿਰ ਅਸੀਂ ਪੰਜਾਬੀ ਵਿੱਚ ਗੱਲ ਕਰਦੇ ਹਨ ਪੰਜਾਬੀ ਸਾਨੂੰ ਬਹੁਤ ਹੀ ਪਸੰਦ ਹੈ ਅਸੀਂ ਸ਼ੁਰੂ ਤੋਂ ਹੀ ਪੰਜਾਬੀ ਸਕੂਲ ਵਿੱਚ ਪੜ੍ਹੇ ਹਨ ਅਤੇ ਪੰਜਾਬੀ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਹੈ ਪੰਜਾਬੀ ਵਿੱਚ ਅਸੀਂ ਨੱਚਣਾ ਟੱਪਣਾ ਨੱਚਣਾ ਟੱਪਣਾ ਬਹੁਤ ਪਸੰਦ ਕਰਦੇ ਹਨ ਸਾਨੂੰ ਅਸੀਂ ਪੰਜਾਬੀ ਵਿੱਚ ਹੀ ਕਿਸੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਨ ਤਾਂ ਪੰਜਾਬੀ ਵਿੱਚ ਹੀ ਅਸੀਂ ਗੱਲ ਕਰਦੇ ਹਨ ਅਸੀਂ ਪੜ੍ਹਦੇ ਸੀ ਸਕੂਲਾਂ ਵਿੱਚ ਹੀ ਪੰਜਾਬੀ ਹੀ ਜ਼ਿਆਦਾਤਰ ਪੜ੍ਹੀ ਹੈ ਪੰਜਾਬੀ ਵਿੱਚ ਹੀ ਅਸੀਂ ਪੰਜਾਬੀ ਜ਼ਿਆਦਾਤਰ ਹੀ ਅਸੀਂ ਪੜ੍ਹੀ ਆ ਪੰਜਾਬੀ ਵਿੱਚ ਅਸੀਂ ਗਾਉਣ ਬਜਾਉਣ ਗਾਉਣਾ ਬਜਾਉਣਾ ਪੰਜਾਬੀ ਵਿੱਚ ਹੀ ਅਸੀਂ ਗਾਣੇ ਸੁਣਦੇ ਹਨ ਸੁਣਦੇ ਹਨ ਅਸੀਂ ਪੰਜਾਬੀ ਵਿੱਚ ਹੀ ਗਾਣੇ ਸੁਣਦੇ ਹਨ ਪੰਜਾਬੀ ਵਿੱਚ ਅਸੀਂ ਘਰ ਪੰਜਾਬੀ ਗਾਣੇ ਲਗਾ ਕੇ ਭੰਗੜਾ ਵਗੈਰਾ ਪਾਉਂਦੇ ਹਨ ਪੰਜਾਬੀ ਗਾਣੇ ਮੈਨੂੰ ਪੰਜਾਬੀ ਗਾਣੇ ਮੈਨੂੰ ਬਹੁਤ ਪਸੰਦ ਹਨ ਅਤੇ ਸਾਰੇ ਅਸੀਂ ਗੱਲਬਾਤ ਜਦੋਂ ਕਿਸੇ ਨਾਲ ਅਸੀਂ ਜਦੋਂ ਵੀ ਕਿਸੇ ਨਾਲ ਕਰਦੇ ਹਾਂ ਅਤੇ ਪੰਜਾਬੀ ਵਿੱਚ ਹੀ ਅਸੀਂ ਜ਼ਿਆਦਾ ਗੱਲ ਕਰਦੇ ਹਨ ਕਿਤੇ ਵੀ ਜਾਈਏ ਅਸੀਂ ਕੋਈ ਫਾਰਮ ਫੁਰਮ ਵਗੈਰਾ ਭਰਵਾਉਣ ਵਾਸਤੇ ਅਸੀਂ ਪੰਜਾਬੀ ਵਿੱਚ ਹੀ ਗਾਣੇ ਗੱਲ ਵਗੈਰਾ ਕਰਦੇ ਹਨ ਆਪਣੀ ਮੈਡਮਾਂ ਨਾਲ ਵੀ ਅਸੀਂ ਪੰਜਾਬੀ ਵਿੱਚ ਹੀ ਗੱਲਬਾਤ ਕਰਦੇ ਹਨ ਅਸੀਂ ਆਪਣੀ ਮਾਂ ਮੰਮੀ ਡੈਡੀ ਨਾਲ ਸਾਰਿਆਂ ਨਾਲ ਪੰਜਾਬੀ ਵਿੱਚ ਹੀ ਗੱਲ ਕਰਦੇ ਹਨ